ਹਾਂਜੀ ਬੋਲੋ ਹੈਲੋ

ਬੋਲੋ ਜੀ ਕੀ ਕੰਮ ਹੈ ਤੁਹਾਨੂੰ ਦੇਖੋ ਜੀ ਪੁਲਿਸ ਆਪਣੇ ਵੱਲੋਂ ਪੂਰੀ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਰਹੀ ਹੈ ਇਹਨਾਂ ਨਸ਼ਿਆਂ ਵਿਰੁੱਧ ਸਾਡੇ ਵੱਲੋਂ ਕਈ ਕੋਸ਼ਿਸ਼ਾਂ ਚੱਲ ਰਹੀਆਂ ਹਨ ਅਤੇ ਸਰਕਾਰ ਜਿਹੜੀ ਹੈ ਉਹ ਵੀ ਕਾਫ਼ੀ ਹੱਦ ਤੱਕ ਪਾਬੰਦੀਆਂ ਲਗਾ ਰਹੀ ਜਿਵੇਂ ਕਿ ਸਖ਼ਤ ਕਾਨੂੰਨ ਬਣਾ ਕੇ ਨਸ਼ਾ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਕਰਕੇ ਹਾਂਜੀ ਨਵੀਂ ਤੋਂ ਨਵੀਂ ਤਕਨੋਲੋਜੀ ਦੀ ਵਰਤੋਂ ਕਰ ਕੇ ਵੀ ਨਸ਼ਿਆਂ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ ਬਸ ਇਹ ਹੈ ਕਿ ਜਨਤਾ ਵੀ ਪੁਲਿਸ ਨਾਲ਼ ਥੋੜ੍ਹਾ ਜਿਹਾ ਸਾਥ ਦੇਵੇ ਤਾਂ ਜੋ ਨਸ਼ਾ ਕਰਨ ਵਾਲਾ ਵੀ ਕੋਈ ਵਿਅਕਤੀ ਨਾ ਹੋਵੇ ਮੇਰੀ ਤਾਂ ਜੀ ਬਸ ਜਨਤਾ ਨੂੰ ਇਹ ਅਪੀਲ ਹੈ ਕਿ ਉਹ ਵੀ ਪੰਜਾਬ ਪੁਲਿਸ ਨਾਲ਼ ਜੋ ਬਣਾ ਕੇ ਰੱਖੇ ਧੰਨਵਾਦ ਜੀ ਧੰਨਵਾਦ